ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੀਮਾ ਜੀ ਬੋਲਦੇ ਤੁਸੀਂ ਹਾਂਜੀ ਸਾਡੇ ਮੈਂ ਵਾਰਡ ਨੰਬਰ ਪੰਜ 'ਚੋ ਬੋਲਦੇ ਸੀਗੇ ਜੀ ਸਾਡੇ ਨਾ ਇੱਧਰ ਸੜਕਾਂ ਟੁੱਟੀਆਂ ਪਈਆਂ ਨੇਗੀਆਂ ਇਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਲੈਟ ਦਾ ਵੀ ਪ੍ਰਬੰਧ ਕੀਤਾ ਜਾਵੇ ਨਾਲੀਆਂ ਟੁੱਟੀਆਂ ਪਈਆਂ ਨੇ ਇੰਨੀਆਂ ਜ਼ਿਆਦਾ ਪਾਣੀ ਖੜ੍ਹਦਾ ਪਿਆ ਕੋਈ ਪਾਣੀ ਨਹੀਂ ਸਫਾਈ 'ਚ ਲੰਘਦਾ ਹਾਂਜੀ ਹਾਂਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਅੱਛਾ ਜੀ ਹਾਂਜੀ ਸੜਕਾਂ ਟੁੱਟੀਆਂ ਪਈਆਂ ਨੇਗੀਆਂ ਅਤੇ ਨਾਲੀਆਂ ਦਾ ਪਾਣੀ ਵੀ ਮਤਲਬ ਨਾਲੀਆਂ ਵੀ ਟੁੱਟੀਆਂ ਹੋਈਆਂ ਨੇ ਉਹਨਾਂ ਦੇ ਪਾਣੀ ਰੁਕਦਾ ਹੈ ਦਰਵਾਜੇ ਅੱਗੇ ਖੜ੍ਹ ਜਾਂਦਾ ਪਾਣੀ ਸਮੈਲ ਆਉਂਦੀ ਹੈਗੀ ਹਾਂਜੀ ਵੈਸੇ ਤੁਸੀਂ ਵਧੀਆ ਕੰਮ ਕਰਦੇ ਹੋਊਂਗੇ ਅੱਛਾ ਜੀ ਵੈਸੇ ਤੁਸੀਂ ਕੰਮ ਵਧੀਆ ਕਰਦੇ ਹੋਊਂਗੇ ਅਤੇ ਸਾਡੇ ਵੱਲ ਵੀ ਧਿਆਨ ਦਿਓ ਥੋੜ੍ਹਾ ਅਤੇ ਲਾਈ ਲਾਈਟ ਦਾ ਵੀ ਪ੍ਰਬੰਧ ਕਰਿਓ ਜੀ ਹਾਂਜੀ ਬਿਜਲੀ ਦਾ ਵੀ ਬਿਲਕੁਲ ਵੀ ਨਹੀਂ ਆਉਂਦੀ ਸਵੇਰੇ ਚਲੀ ਜਾਂਦੀ ਹੈਗੀ ਸ਼ਾਮ ਨੂੰ ਅੱਠ ਨੌਂ ਵਜੇ ਆਉਂਦੀ ਹੈਗੀ ਪਾਣੀ ਵੀ ਨਹੀਂ ਹੁੰਦਾ ਹੈਗਾ ਗਾ ਫਿਰ ਘਰ ਦੇ ਕੰਮ ਔਖਾ ਹੁੰਦਾ ਠੀਕ ਹੈ ਹਾਂਜੀ ਜ਼ਰੂਰ ਕਰਵਾਇਓ ਜੀ ਠੀਕ ਹੈ ਓਕੇ ਜੀ ਓਕੇ ਓਕੇ